ਸਤਿ ਸ਼੍ਰੀ ਅਕਾਲ ਜੀ ਜੀ ਮੈਂ ਨਾ ਤੁਹਾ ਨਿਊ ਸਟੂਡੈਂਟ ਆਈ ਹਾਂ ਇੰਸਟੀਟਿਊਸ਼ਨ ਦੇ ਵਿੱਚ ਅਤੇ ਮੈਨੂੰ ਗੁਰਦਾਸਪੁਰ ਦੇ ਕਲਾਈਮੇਟ ਦੇ ਬਾਰੇ ਕੁਝ ਦੱਸ ਦਿਓ ਕਿ ਇੱਥੇ ਕੀ ਹਿਸਾਬ ਕਿਤਾਬ ਹੈ ਅੱਛਾ ਅਤੇ ਮਤਲਬ ਮੈਂ ਆਪਣੇ ਗਰਮੀ ਔਰ ਸਿਆਲ ਦੇ ਕੱਪੜੇ ਦੋਵੇਂ ਇਕੱਠੇ ਹੀ ਬਾਹਰ ਰੱਖਾਂ ਕਿ ਠੀਕ ਠੀਕ ਟਾ ਟਾਈਮ ਤਕ ਹਿਸਾਬ ਨਾਲ ਮੈਨੂੰ ਕੁਝ ਪਤਾ ਲੱਗ ਜਏਗਾ ਓਕੇ ਓਕੇ ਥੈਂਕ ਯੂ ਓਕੇ ਬਾਏ